ਹਾਂਜੀ ਅਗਰ ਜੇ ਅਸੀਂ ਗੱਲ ਕਰੇ ਕੀੜੇ ਮਕੌੜਿਆਂ ਦੀ ਕੀੜੇ ਮਕੌੜੇ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਤਾਂ ਹੁੰਦੇ ਆ ਸਾਡੇ ਮਿੱਤਰ ਕੀੜੇ ਇੱਕ ਜੋ ਕਿ ਸਾਡੀਆਂ ਫਸਲਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦੇ ਹਨ ਉਹ ਸਾਡੀ ਫਸਲਾਂ ਦੀ ਜੋ ਉੱਪਰ ਗੰਦਗੀ ਮੌਸਮ ਦੇ ਪ ਹਿਸਾਬ ਨੂੰ ਗੰਦਗੀ ਫੈਲ ਜਾਂਦੀ ਹੈ ਉਸਨੂੰ ਉਹ ਖਾ ਕੇ ਖਤਮ ਕਰ ਦਿੰਦੇ ਹਨ ਇੱਕ ਹੁੰਦਾ ਸਾਡੇ ਨੁਕਸਾਨਦਾਇਕ ਕੀੜੇ ਜਿਵੇਂ ਟਿੱਡੀ ਦਲ ਹੋ ਗਿਆ ਉਹ ਸਾਡੀਆਂ ਫਸਲਾਂ ਨੂੰ ਉੱਪਰੋਂ ਪੱਤੇ ਅੰ ਉਹਨਾਂ ਦੇ ਪੱਤੇ ਖਾ ਕੇ ਉਹਨਾਂ ਦੇ ਉਹਨਾਂ ਨੂੰ ਸੁਕਾਉਣ ਦੇ ਵਿੱਚ ਸਾਡੇ ਅ ਫਸ ਫਸਲਾਂ ਨੂੰ ਬਰਬਾਦ ਕਰਨ ਦੇ ਵਿੱਚ ਯੋਗਦਾਨ ਪਾਉਂਦੇ ਹਨ ਕੁ ਕੁਛ ਕੀੜੇ ਜੋ ਕਿ ਜੜ੍ਹਾਂ ਦੇ ਵਿੱਚ ਲੱਗ ਜਾਂਦੇ ਹਨ ਉਹ ਸਾਡੀਆਂ ਜੋ ਪੌਦਾ ਹੁੰਦਾ ਹੈ ਉਸ ਨੂੰ ਜੜ੍ਹ ਤੋਂ ਹੀ ਖਤਮ ਕਰ ਦਿੰਦੇ ਹਨ ਪੂਰਾ ਪੌਦਾ ਹੀ ਨਸ਼ਟ ਕਰ ਦਿੰਦੇ ਹਨ ਇਸ ਕਰਕੇ ਸਾਨੂੰ ਮਿੱਤਰ ਕੀੜਿਆਂ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਜੋ ਸਾਡੇ ਕੀੜੇ ਹਾਨੀਕਾਰਕ ਹੁੰਦੇ ਹਨ ਉਹਨਾਂ ਨੂੰ ਖਤਮ ਕਰਨ ਲਈ ਅਲੱਗ ਅਲੱਗ ਤਰ੍ਹਾਂ ਦੀਆਂ ਸਪਰੇਹਾਂ ਕਰਨੀਆਂ ਚਾਹੀਦੀਆਂ ਹਨ ਜਿਵੇਂ ਕਿ ਚੂਹਾ ਚੂਹਾ ਸਾਨੂੰ ਫਸਲ ਨੂੰ ਖਾਂਦਾ ਹੈ ਅਤੇ ਇਸਦੇ ਅਨੁਕੂਲ ਇੱਕ ਸੱਪ ਹੁੰਦਾ ਹੈ ਜੋ ਸੱਪ ਸਾਡਾ ਚੂਹੇ ਨੂੰ ਖਾ ਜਾਂਦਾ ਹੈ ਇਸ ਕਰਕੇ ਇਹ ਅਨੁਕੂਲ ਕੁਛ ਕੀੜੇ ਸਾਡੇ ਲਈ ਫੰ ਫਾਇਦੇਮੰਦ ਹੁੰਦੇ ਹਨ ਕੁਛ ਕੀੜੇ ਸਾਡੇ ਲਈ ਹਾਨੀਕਾਰਕ ਹੁੰਦੇ ਹਨ